ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਸਿੱਖਿਆ ਦੀ ਗੱਲ ਕਰੀਏ ਤਾਂ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸਕੂਲ ਹਨ ਜਿਵੇਂ ਸ਼ਿਵਾਲਿਕ ਸਕੂਲ ਹੈ ਉਸ ਤੋਂ ਬਿਨਾਂ ਸਭ ਤੋਂ ਬੜੀ ਗੱਲ ਹੈ ਕਿ ਇਸ ਰੋਪੜ ਦੇ ਵਿੱਚ ਇੱਕ ਆਈ ਆਈ ਟੀ ਆ ਗਈ ਹੈ ਜਿਸ ਦੇ ਨਾਲ ਬਹੁਤ ਲੋਕਾਂ ਨੂੰ ਜਾਗਰੂਕਤਾ ਮਿਲੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾ ਸਕੀਏ ਔਰ ਟੈਕਨੋਲਜੀ ਬਾਰੇ ਬਹੁਤ ਜ਼ਿਆਦਾ ਨੌਲੇਜ ਆ ਸਕਦੀ ਹੈ ਇਸ ਤੋਂ ਬਿਨਾਂ ਇੱਕ ਕਈ ਇੱਕ ਪ੍ਰਾਈਵੇਟ ਸਕੂਲ ਹੈ ਉਨ੍ਹਾਂ ਦੇ ਵਿੱਚ ਬਹੁਤ ਵਧੀਆ ਸਿਕਸ਼ਾ ਦਿੱਤੀ ਜਾਂਦੀ ਹੈ ਪਰ ਅੱਜ ਕੱਲ੍ਹ ਸਰਕਾਰ ਗੌਰਮੈਂਟ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜਿਸ ਦੇ ਨਾਲ ਗੌਰਮੈਂਟ ਸਕੂਲ ਦੀ ਵੀ ਸਥਿਤੀ ਠੀਕ ਹੋ ਰਹੀ ਹੈ ਔਰ ਲੇਕਿਨ ਇਸ ਸਮਾਜ ਦੇ ਵਿੱਚ ਇੱਕ ਸਭ ਤੋਂ ਬੜੀ ਕੁਰੀਤੀ ਹੈ ਜਿਹੜੀ ਕਿ ਔਰਤਾਂ ਦੇ ਨਾਲ ਭੇਦ ਭਾਵ ਕਰਨਾ ਕਿ ਕੁੜੇਮ ਕੁੜੀ ਅਤੇ ਮੁੰਡੇ ਦੇ ਵਿੱਚ ਫਰਕ ਰੱਖਣਾ ਅ ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਦੇ ਬਾਪ ਨੂੰ ਦਹੇਜ ਵਾਸਤੇ ਮਜਬੂਰ ਕਰਨਾ ਕਿਸੇ ਕੋਲੋਂ ਗੱਡੀ ਮੰਗ ਲਈ ਮੰਗਦੇ ਸਾਰੇ ਅੰਦਰੂਨੀ ਆ ਲੇਕਿਨ ਇਹ ਸੱਚਾਈ ਆ ਔਰ ਇਸ ਤਰੀਕੇ ਦੀ ਨਹੀਂ ਹੋਣਾ ਚਾਹੀਦਾ ਇੱਕ ਕਿਸੇ ਵੀ ਕੁੜੀ ਦੇ ਬਾਪ ਦੇ ਉੱਪਰ ਬੋਝ ਨਹੀਂ ਹੋਣਾ ਚਾਹੀਦਾ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਔਰਤਾਂ ਨੂੰ ਬਰਾਬਰ ਦੀ ਜਿਹੜੀ ਸਰਵਿਸ ਆ ਉਹ ਪ੍ਰੋਵਾਈਡ ਕੀਤੀ ਜਾ ਸਰਵਿਸ ਦਿੱਤੀ ਜਾਵੇ ਔਰ ਇਸ ਦੇ ਨਾਲ ਔਰਤ ਦਾ ਜਿਹੜਾ ਸ਼ਸ਼ਕਤੀਕਰਨ ਆ ਉਹ ਹੋ ਜਾਵੇਗਾ ਔਰ ਰੁਜ਼ਗਾਰ ਮਿਲੇਗਾ ਅਗਰ ਨੌਕਰੀ ਹੋਊਗੀ ਤਾਂ ਔਰਤਾਂ ਅੱਗੇ ਵਧ ਸਕਦੀਆਂ ਔਰ ਕਿਸੇ ਵੀ ਔਰਗੇਨਾਈਜੇਸ਼ਨ ਦੇ ਵਿੱਚ ਉਸ ਨੂੰ ਨੌਕਰੀ ਦਿੱਤੀ ਜਾ ਸਕਦੀ ਆ ਸਭ ਤੋਂ ਬੜੀ ਇੱਕ ਕੁਰੀਤੀ ਜੋ ਹੋਰ ਵੀ ਦੇਖਣ ਵਿੱਚ ਆ ਰਹੀ ਆ ਸਮਾਜ ਦੇ ਵਿੱਚ ਉਹ ਆ ਕਿ ਜਾਤ ਪਾਤ ਇਹ ਨਹੀਂ ਹੋਣਾ ਚਾਹੀਦੀ ਜੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪੁਰਾਣੇ ਸਦੀਆਂ ਪੁਰਾਣੀ ਚੱਲੀ ਆ ਰਹੀ ਹੈ ਲੇਕਿਨ ਖਤਮ ਨਹੀਂ ਹੋ ਰਹੀ ਇਹਨੂੰ ਕਰਨਾ ਚਾਹੀਦਾ ਇਹਦੇ ਉੱਪਰ ਦੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਔਰ ਬਾਕੀ ਇਹੀ ਕੁਛ